ਹਾਂਜੀ ਬੁਣਨਾ ਅਤੇ ਸਿਲਾਈ ਕਰਨਾ ਬਹੁਤ ਹੀ ਵਧੀਆ ਕਲਾ ਹੈ ਅਤੇ ਮੈਂ ਇਹ ਕਲਾ ਸਰਕਾਰੀ ਆਈ ਟੀ ਆਈ ਜੋ ਕਿ ਮੇਰੇ ਘਰ ਦੇ ਕੋਲ ਸਥਿਤ ਹੈ ਉਸ ਤੋਂ ਪ੍ਰਾਪਤ ਕੀਤੀ ਮੈਨੂੰ ਸ਼ੁਰੂ ਤੋਂ ਹੀ ਸਿਲਾਈ ਕਰਨਾ ਬਹੁਤ ਵਧੀਆ ਲੱਗਦਾ ਸੀ ਜਿਸ ਕਰਕੇ ਮੈਂ ਸਿਲਾਈ ਸਿੱਖੀ ਅਤੇ ਕਟਾਈ ਸਿੱਖੀ ਅਤੇ ਮੈਨੂੰ ਬੁਣਨਾ ਵੀ ਬਹੁਤ ਚੰਗਾ ਲੱਗਦਾ ਹੈ ਅਤੇ ਮੈਂ ਆਪਣੀ ਦਾਦੀ ਤੋਂ ਬੁਣਨਾ ਵੀ ਸਿੱਖਿਆ ਅਤੇ ਮੈਨੂੰ ਯਾਦ ਹੈ ਆਈ ਟੀ ਆਈ ਦੇ ਵਿੱਚ ਜਿਹੜੇ ਮੇਰੇ ਅਧਿਆਪਕ ਸਾਹਿਬਾਨ ਨੇ ਉਨ੍ਹਾਂ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਸਿਲਾਈ ਕਰਨ ਦਾ ਨਵਾਂ ਨਵੇਂ ਨਵੇਂ ਨੁਸਖੇ ਦੱਸੇ ਜਿਸ ਜਿਹੜੇ ਕਿ ਮੈਨੂੰ ਬਹੁਤ ਪਸੰਦ ਆਏ ਅਤੇ ਹੁਣ ਮੈਂ ਉਨ੍ਹਾਂ ਨੂੰ ਲਾਗੂ ਕਰਦੀ ਹਾਂ ਅਤੇ ਮੈਨੂੰ ਬਹੁਤ ਚੰਗਾ ਲੱਗਦਾ ਹੈ ਜਦੋਂ ਮੈਂ ਸਿਲਾਈ ਕਰਕੇ ਨਵਾਂ ਕੱਪੜਾ ਆਪਣੇ ਆਪ 'ਤੇ ਪਾਉਂਦੀ ਹਾਂ